ਹਾਂਜੀ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਹਰ ਸਾਲ ਸ਼ਹੀਦੀ ਸਾਲਾਨਾ ਯਾਤਰਾ ਮੇਲਾ ਲੱਗਦਾ ਹੈ ਇਹ ਮੇਲਾ ਚੌਵੀ ਪੱਚੀ ਛੱਬੀ ਦਸੰਬਰ ਨੂੰ ਤਿੰਨ ਦਿਨ ਲੱਗਦਾ ਹੈ ਇਹ ਮੇਲਾ ਤਾਂ ਮਨਾਇਆ ਜਾਂਦਾ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਵਜ਼ੀਰ ਖਾਨ ਨੇ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਇੱਥੇ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ ਸ਼ਰਧਾਲੂ ਬਹੁਤ ਹੀ ਸ਼ਰਧਾ ਦੇ ਨਾਲ ਇੱਥੇ ਢੁਕਦੇ ਹਨ ਅਤੇ ਆ ਕੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿੱਚ ਮੱਥਾ ਟੇਕਦੇ ਹਨ ਮੈਂ ਬਚਪਨ ਤੋਂ ਹੀ ਇਸ ਮੇਲੇ 'ਤੇ ਜਾਂਦਾ ਹਾਂ ਮੈਂ ਬਹੁਤ ਹੀ ਸ਼ਰਧਾ ਨਾਲ ਇਸ ਮੇਲੇ 'ਤੇ ਜਾਂਦਾ ਹਾਂ ਥਾਂ ਥਾਂ 'ਤੇ ਲੰਗਰ ਚਲਦੇ ਹੁੰਦੇ ਹਨ ਮੈਂ ਲੰਗਰ ਵੀ ਜਾ ਕੇ ਖਾਂਦਾ ਹਾਂ ਮੇਲਾ ਬਹੁਤ ਹੀ ਧੂਮਧਾਮ ਨਾਲ ਇੱਥੇ ਲੱਗਦਾ ਹੈ ਬਹੁਤ ਹੀ ਦੁਕਾਨਾਂ ਹੁੰਦੀਆਂ ਹਨ ਖਿਡੌਣਿਆਂ ਦੀਆਂ ਕੱਪੜਿਆਂ ਦੀਆਂ ਆਦਿ ਖਿਡੌਣੇ ਵੀ ਖਰੀਦਦਾ ਰਿਹਾ ਹਾਂ ਬਚਪਨ ਦੇ ਵਿੱਚ ਅਸੀਂ ਪੈਦਲ ਜਾਂਦੇ ਹੁੰਦੇ ਸੀ ਮੇਲੇ 'ਤੇ ਮੈਨੂੰ ਅੱਜ ਵੀ ਯਾਦ ਹੈ ਸਵੇਰੇ ਅਸੀਂ ਤੁਰ ਕੇ ਜਾਂਦੇ ਹੁੰਦੇ ਸੀ ਅਤੇ ਸ਼ਾਮ ਨੂੰ ਹਨੇਰੇ ਹੋਏ ਤੁਰ ਕੇ ਜਾਂਦੇ ਹੁੰਦੇ ਸੀ ਉੱਥੇ ਸਾਰਾ ਦਿਨ ਅਸੀਂ ਪੈਦਲ ਯਾਤਰਾ ਕਰਦੇ ਸੀ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਦੇ ਸੀ ਲੰਗਰ ਛੱਕ ਕੇ ਮੈਂ ਖਿਡੌਣੇ ਲੈਂਦਾ ਸੀ ਅਤੇ ਵਾਪਸ ਘਰ ਆ ਜਾਂਦਾ ਸੀ